ਇੰਡੀਆ ਨਿਊਜ਼ੀਲੈਂਡ ਪਾਕਿਸਤਾਨ ਮਹਾਰਾਸ਼ਟਰ ਪੰਜਾਬ ਹਰਿਆਣਾ ਬਰਮਿੰਘਮ ਰਿਪਬਲਿਕ ਔਫ ਡੈਮੋਕਰੇਟ ਕੋਂਗੋ ਕਨੇਡਾ ਯੂ ਏ ਈ ਯੂ ਐਸ ਏ ਰਸ਼ੀਆ ਜਪਾਨ ਚਾਈਨਾ ਨੌਰਥ ਕੋਰੀਆ ਬੈਲਜੀਅਮ ਮਹਾਰਾਸ਼ਟਰ ਦਿੱਲੀ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬੈਲਜੀਅਮ ਅਰਜਨਟੀਨਾ ਬ੍ਰਾਜ਼ੀਲ ਤੇਲਗਾਨਾ ਅਤੇ ਪਾਕਿਸਤਾਨ ਕਜ਼ਾਕਿਸਤਾਨ ਬੰਗਲਾਦੇਸ਼ ਨੇਪਾਲ ਅਫਗਾਨਿਸਤਾਨ ਤਰਕੀ ਸਿੰਘਾਪੁਰ ਥਾਈਲੈਂਡ ਮਲੇਸ਼ੀਆ ਯੂ ਕੇ ਫਿਨਲੈਂਡ ਜ਼ਰਮਨੀ ਫਰਾਂਸ ਤੁਰਕੀ ਇਟਲੀ